ਸਾਡੇ ਖੇਤਰ ਦੀਆਂ ਖੇਡਾਂ ਕਬੱਡੀ ਖੋ ਖੋ ਗੁੱਲੀ ਡੰਡਾ ਬਾਰਾ ਡੀਕਰੀ ਬਾਂਦਰ ਕੀਲਾ ਇਹ ਸਾਡੇ ਖੇਤਰ ਦੀਆਂ ਖੇਡਾਂ ਹਨ ਪਰ ਅੱਜ ਦੀਆਂ ਅੱਜ ਦੇ ਰਾਜ ਦੀਆਂ ਖੇਡਾਂ ਸਾਡੀਆਂ ਖੇਡਾਂ ਨਾਲੋਂ ਬਹੁਤ ਅਲੱਗ ਹਨ ਕਿਉਂਕਿ ਅੱਜ ਦੀਆਂ ਖੇਡਾਂ ਜ਼ਿਆਦਾਤਰ ਫੋਨਾਂ 'ਤੇ ਹੀ ਖੇਡੀਆਂ ਜਾਂਦੀਆਂ ਹਨ ਬੱਚਿਆਂ ਨੂੰ ਮਤਲਬ ਸਾਡੀਆਂ ਪਿਛਲੀਆਂ ਖੇਡਾਂ ਬਾਰੇ ਕੁਛ ਨਹੀਂ ਜਾਣਕਾਰੀ ਹੈਗੀ ਇਸ ਲਈ ਬੱਚੇ ਹਮੇਸ਼ਾ ਫੋਨਾਂ 'ਤੇ ਹੀ ਲੱਗੇ ਰਹਿੰਦੇ ਹਨ ਇਸ ਨਾਲ ਬੱਚਿਆਂ ਨੂੰ ਪੁਰਾਣੇ ਕਲਚਰ ਪੁਰਾਣੀਆਂ ਖੇਡਾਂ ਬਾਰੇ ਕੁਛ ਵੀ ਨਹੀਂ ਪਤਾ ਹੈਗਾ ਤਾਂ ਇਸ ਲਈ ਜ਼ਿਆਦਾਤਰ ਹੁਣ ਫੂਨ ਦੀ ਹੀ ਯੁ ਵਰਤੋਂ ਹੁੰਦੀ ਹੈ ਪਹਿਲਾਂ ਵਾਲੇ ਸਮੇਂ ਵਿੱਚ ਸਾਰੇ ਜਣੇ ਇਕੱਠੇ ਹੋ ਕੇ ਖੇਡਦੇ ਸੀਗੇ ਜਿਵੇਂ ਕਬੱਡੀ ਖੋ ਖੋ ਇੱਦਾਂ ਦੀਆਂ ਬਹੁਤ ਸਾਰੀਆਂ ਖੇਡਾਂ ਸੀਗੀਆਂ ਜਿਹੜੀਆਂ ਅਸੀਂ ਸਾਰੇ ਰਲ ਮਿਲ ਕੇ ਖੇਡਦੇ ਸੀਗੇ ਪਰ ਅੱਜ ਦੇ ਬੱਚੇ ਬਸ ਫੋਨ 'ਤੇ ਹੀ ਖੇਡਦੇ ਹਨ ਇੱਕ ਦੂਜੇ ਨਾਲ ਕੋਈ ਵੀ ਇੱਦਾਂ ਦੀ ਖੇਡ ਨਹੀਂ ਖੇਡਦੇ ਜੋ ਪਹਿਲਾਂ ਵਾਲੇ ਸਮਿਆਂ ਵਿੱਚ ਖੇਡੀਆਂ ਜਾਂਦੀਆਂ ਸੀ ਅਤੇ ਅੱਜ ਕੱਲ੍ਹ ਦੇ ਬੱਚੇ ਬਸ ਫੋਨ ਵਾਲੀਆਂ ਗੇਮਾਂ 'ਤੇ ਹੀ ਜ਼ਿਆਦਾਤਰ ਨਿਰਭਰ ਹਨ ਇਸ ਕਰਕੇ ਪਹਿਲਾਂ ਵਾਲੀਆਂ ਖੇਡਾਂ ਬੱਚਿਆਂ ਨੂੰ ਨਹੀਂ ਪਤਾ ਹੈਗੀਆਂ